ਭੰਗੜਾ ਸਾਡੇ ਪੰਜਾਬ ਦੀ ਸ਼ਾਨ ਹੈ ਇਸ ਸਾਡੇ ਪੰਜਾਬ ਵਿੱਚ ਭੰਗੜੇ ਨੂੰ ਬਹੁਤ ਉੱਪਰ ਮੰਨਿਆ ਜਾਂਦਾ ਸੀ ਬਟ ਹੁਣ ਪਿੱਛੇ ਜਿਹੇ ਇਹ ਭੰਗੜਾ ਸਾਡਾ ਕਿਤੇ ਖੋ ਗਿਆ ਸੀ ਗਵਾਚ ਗਿਆ ਸੀਗਾ ਅਤੇ ਇਹ ਹੁਣ ਜਿਹੜੀ ਅੱਜ ਕੱਲ੍ਹ ਫਿਰ ਦੁਬਾਰਾ ਨਵੀਂ ਯੂਥ ਆਈ ਹੈ ਇਹਨੇ ਫਿਰ ਭੰਗੜੇ ਨੂੰ ਬਹੁਤ ਮਹੱਤਵ ਦਿੱਤਾ ਹੈ ਤਾਂ ਮੈਨੂੰ ਭੰਗੜਾ ਬਹੁਤ ਹੀ ਪਸੰਦ ਹੈ ਭੰਗੜੇ ਨਾਲ ਤੁਹਾਡੀ ਇੱਕ ਤਰ੍ਹਾਂ ਦੀ ਐਕਸਰਸਾਈਜ਼ ਕਸਰਤ ਵੀ ਹੋ ਜਾਂਦੀ ਹੈ ਔਰ ਤੁਹਾਡਾ ਮ ਮੰਨ ਵੀ ਬਿਲਕੁਲ ਖੁਸ਼ ਹੋ ਜਾਂਦਾ ਹੈ ਅਤੇ ਮੈਂ ਪਿੱਛੇ ਜਿਹੇ ਆਪਣੇ ਮਤਲਬ ਇਹ ਮੈਂ ਵੀ ਛੱਡ ਦਿੱਤਾ ਸੀ ਹੁਣ ਦੁਬਾਰਾ ਤੋਂ ਮੈਂ ਇਸ ਨੂੰ ਸ਼ੁਰੂ ਕੀਤਾ ਹੈ ਮੇਰੀ ਇਸ ਵਿੱਚ ਬਹੁਤ ਹੀ ਰੁਚੀ ਹੈ ਮੈਂ ਮੈਂ ਆਪਣੀ ਇੱਕ ਭੰਗੜੇ ਦੀ ਕਲਾਸ ਵੀ ਸ਼ੁਰੂ ਕੀਤੀ ਹੈ ਉਹਦੇ 'ਚ ਮੈਂ ਰੋਜ਼ ਜਾਂਦੀ ਹਾਂ ਜਿਹਦੇ 'ਚ ਮੈਨੂੰ ਯੋਗਾ ਕਰਵਾਉਂਦੇ ਹੈ ਤਾਂ ਥੋੜ੍ਹੀ ਬਹੁਤੀ ਕਸਰਤ ਹੁੰਦੀ ਹੈ ਨਾਲ ਭੰਗੜੇ ਦੀ ਕਲਾਸ ਲੱਗਦੀ ਹੈ ਇਹਦੇ ਵਿੱਚ ਮੇਰਾ ਕਾਫੀ ਮਨ ਵੀ ਮਤਲਬ ਚੇਂਜ ਹੋ ਜਾਂਦਾ ਹੈ ਪੂਰਾ ਮਾਹੌਲ ਚੇਂਜ ਹੋ ਜਾਂਦਾ ਹੈ ਤੁਹਾਡਾ ਦਿਲ ਲੱਗ ਜਾਂਦਾ ਹੈ ਇਹ ਕਸਰਤ ਦੀ ਕਸਰਤ ਹੋ ਜਾਂਦੀ ਹੈ ਅਤੇ ਪੰਜਾਬ 'ਚ ਭੰਗੜੇ ਦਾ ਬਹੁਤ ਹੀ ਮਹੱਤਵ ਹੈ